ਪੇਂਡੂ ਖੇਤਰਾਂ ਦੇ ਵਿੱਚੋਂ ਬਾਹਰ ਯਾਤਰਾ ਕਰਦੇ ਸਮੇਂ ਸਾਡੇ ਜੀਵਨ ਦੇ ਵਿੱਚ ਆਉਣ ਵਾਲੀ ਕੁਝ ਸਮੱਸਿਆਵਾਂ ਅਜਿਹੀਆਂ ਨੇ ਜਿਵੇਂ ਅਸੀਂ ਆਖ ਸਕਦੇ ਹਾਂ ਜਿਹੜੇ ਪੇਂਡੂ ਜਿਹੜੇ ਕਸਬਿਆਂ ਦੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਸਿੱਖਿਆ ਨਾ ਹੋਣ ਕਰਕੇ ਨੌਲੇਜ ਨਾ ਹੋਣ ਕਰਕੇ ਜਿਹੜੀ ਦਿੱਕਤ ਹੈ ਉਹਨਾਂ ਨੂੰ ਰਸਤਿਆਂ ਦੀ ਆਉਂਦੀ ਹੈ ਅੱਜ ਦੀ ਘੜੀ ਆਬਾਦੀ ਡਿਵੈਲਪਮੈਂਟ ਦੇ ਕਾਰਨ ਜਿਵੇਂ ਗੂਗਲ ਮੈਪ ਵਗੈਰਾ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਤੋਂ ਜਿਹੜਾ ਸਾਡਾ ਜਿਹੜਾ ਰਸਤਾ ਹੈ ਸਾਡਾ ਸਫਰ ਹੈ ਤੈਅ ਕਰ ਲਿਆ ਜਾਂਦਾ ਪਰ ਜੇਕਰ ਸਾਨੂੰ ਨੌਲੇਜ ਨਹੀਂ ਹੁੰਦੀ ਤਾਂ ਪਿੰਡਾਂ ਦੇ ਵਿੱਚ ਜਦੋਂ ਅਸੀਂ ਬਾਹਰ ਯਾਤਰਾ ਕਰਦੇ ਹਾਂ ਤਾਂ ਸਾਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਾਨੂੰ ਉੱਥੋਂ ਦੇ ਆਮ ਵਸਨੀਕਾਂ ਨੂੰ ਜਿਹੜੇ ਇੱਥੇ ਸਾਨੂੰ ਮਿਲਦੇ ਹਨ ਉਹਨਾਂ ਨੂੰ ਪੁੱਛ ਕੇ ਜਿਹੜਾ ਰਸਤਾ ਤੈਅ ਕਰਨਾ ਪੈਂਦਾ ਹੈ ਔਰ ਦੂਜਾ ਸਭ ਤੋਂ ਵੱਡਾ ਜਿਹੜਾ ਸਾਨੂੰ ਦਿੱਕਤ ਆਉਂਦੀ ਹੈ ਜੇਕਰ ਅਸੀਂ ਆਪਦੇ ਕਸਬਿਆਂ ਤੋਂ ਆਪਣੇ ਪਿੰਡਾਂ ਤੋਂ ਬਾਹਰ ਜਾ ਕੇ ਯਾਤਰਾ ਕਰਦੇ ਹਾਂ ਤਾਂ ਉੱਥੋਂ ਦੀ ਭਾਸ਼ਾ ਜਿਹੜੀ ਆ ਉਹ ਬਦਲ ਜਾਂਦੀ ਹੈ ਕਿਉਂਕਿ ਜਿਹੜਾ ਸਾਡਾ ਭਾਰਤ ਆ ਉਸ ਦੇ ਵਿੱਚ ਵਿਭਿੰਨਤਾਵਾਂ ਪਾਈਆਂ ਜਾਂਦੀਆਂ ਹਨ ਪਰ ਮਤਲਬ ਥੋੜ੍ਹੀ ਲੰਮੀ ਦੂਰੀ ਤੋਂ ਬਾਅਦ ਹੀ ਜਿਹੜੀ ਆ ਭਾਸ਼ਾ ਜਿਹੜੀ ਉਹ ਬਦਲ ਜਾਂਦੀ ਹੈ ਅਤੇ ਸਮਝ ਦੇ ਵਿੱਚ ਕੁਝ ਹੱਦ ਤੱਕ ਤਾਂ ਆਉਂਦੀ ਹੈ ਪਰ ਉਹਦੇ ਵਿੱਚੋਂ ਕਈ ਗੱਲਾਂ ਜਿਹੜੀਆਂ ਨੇ ਸਮਝ ਦੇ ਵਿੱਚੋਂ ਆਉਣੋਂ ਹਟ ਜਾਂਦੀਆਂ ਨੇ ਤਾਂ ਜਿਹੜੀ ਭਾਸ਼ਾ ਹੈ ਇੱਕ ਡਾਈਵਰਸਿਟੀ ਵੀ ਜਿਹੜਾ ਵਿਭਿੰਨਤਾ ਹੈ ਇਸ ਦਾ ਸਭ ਤੋਂ ਵੱਡਾ ਮੁੱਖ ਕਾਰਨ ਮੁਸ਼ਕਲਾਂ ਦੇ ਵਿੱਚ ਆਉਂਦਾ ਹੈ ਭਾਈ ਔਰ ਦੂਸਰੀ ਗੱਲ ਕੀਤੀ ਜਾਵੇ ਤਾਂ ਜਦੋਂ ਪਿੰਡਾਂ ਤੋਂ ਬਾਹਰ ਯਾਤਰਾ ਕੀਤੀ ਜਾਂਦੀ ਹੈ ਤਾਂ ਜਿਹੜੇ ਕਈ ਵਾਰ ਕੀ ਹੁੰਦੇ ਨੇ ਰਸਤੇ ਦੇ ਜਿਹੜੇ ਰੋਡ ਹੁੰਦੇ ਨੇ ਪਿੰਡਾਂ ਦੇ ਵਿੱਚੋਂ ਬਾਹਰ ਨਿਕਲਦੇ ਸਮੇਂ ਉਹ ਕੱਚੇ ਹੁੰਦੇ ਨੇ ਜਾਂ ਟੁੱਟੇ ਹੁੰਦੇ ਨੇ ਤਾਂ ਸਭ ਤੋਂ ਜ਼ਿਆਦਾ ਦਿੱਕਤ ਇਹਨਾਂ ਵਿੱਚ ਆਉਂਦੀ ਹੈ ਜੇਕਰ ਸਾਨੂੰ ਅਸੀਂ ਅਸੀਂ ਬਾਹਰ ਘੁੰਮਦੇ ਹਾਂ ਤਾਂ ਸਾਨੂੰ ਉੱਥੋਂ ਦਾ ਚੰਗੀ ਤਰ੍ਹਾਂ ਜਿਹੜਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਉਸ ਸਥਾਨ ਦੀ ਜਿੱਥੇ ਅਸੀਂ ਘੁੰਮਣ ਦੇ ਲਈ ਜਾ ਰਹੇ ਹਾਂ ਤਾਂ ਇਹ ਹੋਣਾ ਬਹੁਤ ਜ਼ਰੂਰੀ ਹੈ ਧੰਨਵਾਦ